ਉੱਨੀ ਦਸੰਬਰ ਦੋ ਹਜ਼ਾਰ ਸਤਾਰ੍ਹਾਂ ਵੀਹ ਅਪ੍ਰੈਲ ਦੋ ਹਜ਼ਾਰ ਇੱਕ ਸੱਤ ਮਈ ਉੱਨੀ ਸੌ ਅਠਾਨਵੇਂ ਉੱਨੀ ਅਕਤੂਬਰ ਉੱਨੀ ਸੌ ਸਤਾਨਵੇਂ ਚਾਰ ਅਗਸਤ ਉੱਨੀ ਸੌ ਨੜਿਨਵੇਂ